ਹੈਲੋ ਕੰਚਨ ਠੀਕ ਹੈ ਠੀਕ ਹੈ ਠੀਕ ਹੈ ਹੋਰ ਸੁਣਾ ਕੀ ਕਰਦਾ ਪਿਆ ਵਿਹਲਾ ਬੈਠਿਆ ਕੁਛ ਨਹੀਂ ਕਰਦਾ ਪਿਆ ਕੀ ਕੀਤਾ ਸਾਰਾ ਦਿਨ ਅੱਜ

ਹਾਂ ਇਹ ਤਾਂ ਇਹ ਤਾਂ ਹੈਗਾ ਹੀ ਆ ਉਹ ਅੱਗੇ ਕੀ ਸੋਚਿਆ ਕਰਨ ਦਾ ਅੱਛਾ ਅੱਛਾ ਮੈਂ ਤਾਂ ਬੀਟਾ ਬੀਟੈਕ ਸੋਚੀ ਹੈ ਹਾਂ ਬੀਟੈਕ ਕਰਨੀ ਆ ਇਹ ਸੋਚਿਆ ਸੀਗਾ ਹਾਂ ਨੰਬ ਨੰਬਰ ਦੇ ਬੇਸ 'ਚ ਹੀ ਮਿਲਣੀ ਨਾ ਐਡਮਿਸ਼ਨ ਕਿੱਥੇ ਮਿਲਣੀ ਨੰਬਰ ਹਾਂਜੀ ਹਾਂਜੀ ਹਾਂ ਹਾਂ ਆਹੀ ਸੋਚਦੇ ਪਏ ਕੀ ਕਰੀਏ ਕੀ ਨਹੀਂ ਕਰੀਏ ਹਾਂਜੀ ਹਾਂ ਹਾਂ ਹੋਰ ਉਹ ਤਾਂ ਜਾਣਾ ਜਾਣਾ ਹੀ ਪੈਣਾ ਉਹ ਤਾਂ ਜਾਣਾ ਪੈਣਾ ਕੋਲਜ ਦੇ ਵਿੱਚ

ਹਾਂ ਸਰਵਾਨੰਦ ਹੀ ਸੋਚਿਆ ਫਿ ਫਿਲਹਾਲ ਤਾਂ ਸਰਵਾਨੰਦ ਹੀ ਸੋਚਿਆ ਨੰਬਰ ਠੀਕ ਆ ਜਾਣ ਹਾਂ ਨੰਬਰ ਠੀਕ ਆਇਆ ਨਾ ਹਾਂ ਜੇ ਈ ਦੇ ਹਾਂ ਪਹਿਲੇ ਭਰਨਾ ਪੈਂਦਾ ਨਾ ਫਾਰਮ ਵਗੈਰਾ ਜੇ ਈ ਦੇ ਹਾਂਜੀ ਹਾਂ ਹਾਂ ਨੰਮ ਨੰਬਰਾਂ 'ਚ ਹੀ ਹੈ ਨਾ ਨੰਬਰ ਕਿ ਕਿ ਕਿ ਵੀ ਕਿੱਦਾਂ ਦੇ ਨੰਬਰ ਹਾਂ ਉਹ ਤਾਂ ਹੈ ਹੀ ਨੰਬਰ ਹੀ ਹੈ ਦੇਖਦੇ ਨੇ ਅੱਛਾ ਹਾਂ ਹਾਂ ਹਾਂ ਉਹ ਤਾਂ ਘੱਟ ਹੀ ਹੋਣੀ ਫੀਸ ਨਾਈ ਹਾਂ ਨਾਈਨਟੀ ਪ੍ਰਸੈਂਟ ਉੱਪਰ ਆਏ ਤਾਂ ਵੀ ਘੱਟ ਹੋਵੇਗਾ ਸਕਾਲਰਸ਼ਿਪ ਵਗੈਰਾ ਮਿਲ ਜਾਂਦੀ ਇਹ ਹੋ ਜਾਂਦਾ ਇਹ ਇਹ ਹੋ ਜਾਂਦਾ ਹਾਂ ਹਾਂ ਇਕੱਠੇ ਹਾਂ ਇਹ ਸੋਚਦੇ ਪਏ ਤੇ ਹਾਂਜੀ ਹਾਂ ਹਾਂ ਸਰਵਾਨੰਦ ਨਹੀਂ ਹੈਗੇ ਸਰਵਾਨੰਦ ਨਹੀਂ ਆ ਹਾਂ ਬਸ ਇੱਦਾਂ ਹਾਂ ਹਾਂ ਹਾਂ ਉਹ ਦੇ ਤੇ ਠੀਕ ਹੈ ਹੋਰ

ਹਾਂ ਬਾਅਦ ਮੇ ਰਿਜ਼ਲਟ ਆਵੇ ਫਿਰ ਤਾਂ ਹੀ ਪਤਾ ਲੱਗਣਾ ਕਿ ਕਿੱਥੇ ਲਈ ਐਡਮੀਸ਼ਨ ਵਗੈਰਾ ਬਾਅਦ ਮੇ ਹਾਂ ਹਾਂ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਮਿਲਦੇ ਨੇ ਠੀਕ ਹੈ ਨਾ ਅੱਛਾ ਓਕੇ ਜੀ ਓਕੇ ਓਕੇ ਬਾਏ ਜੀ